ਕਾਜੂ ਕਤਲੀ ਬਰਫੀ ਗੁਲਾਬ ਜਾਮੁਨ ਇਮਰਤੀ ਰਸਗੁੱਲਾ ਰਸ ਮਲਾਈ ਸੋਨ ਪਾਪੜੀ ਮੋਦਕ ਬੇਸਨ ਦਾ ਲੱਡੂ ਬਾਲੂਸ਼ਾਹੀ ਰਬੜੀ ਬੂੰਦੀ ਕਲਾ ਕੰਦ ਨਾਨ ਖਟਾਈ